ਪਿਛਲੇ ਕੁਛ ਦਹਾਕਿਆਂ ਦੌਰਾਨ ਭਾਰਤ ਵਿੱਚ ਕਈ ਨਵੇਂ ਤਰ੍ਹਾਂ ਦੀਆਂ ਨੌਕਰੀਆਂ ਅਤੇ ਭੂਮਿਕਾਵਾਂ ਆ ਰਹੀਆਂ ਹਨ ਜਿੱਦਾਂ ਕਿ ਉਦਾਹਰਨ ਦੇ ਤੌਰ 'ਤੇ ਲੋਕ ਯੂਟਿਊਬਰ ਬਣ ਕੇ ਕਾਫੀ ਤਰ੍ਹਾਂ ਦਾ ਗਿਆਨ ਯੂਟਿਊਬ 'ਤੇ ਫੇਸਬੁਕ 'ਤੇ ਵੰਡਦੇ ਹਨ ਜਿਹਦੇ 'ਚ ਉਹਨਾਂ ਨੂੰ ਜਦੋਂ ਜ਼ਿਆਦਾ ਲਾਇਕਸ ਵਗੈਰਾ ਜਾਂ ਸ਼ੇਅਰ ਮਿਲਦੇ ਹਨ ਤਾਂ ਉਹਨਾਂ ਨੂੰ ਪੈਸੇ ਕਮਾਉਣ ਦਾ ਮੌਕਾ ਮਿਲਦਾ ਹੈ ਦੂਜਾ ਉਹ ਫੂ ਫੂ ਬਲੋਕਰ ਵੀ ਬਣਦੇ ਹਨ ਤਾਂ ਕਿ ਉਹ ਨਵੇਂ ਤਰ੍ਹਾਂ ਦੇ ਖਾਣੇ ਬਣਾ ਕੇ ਉੱਥੇ ਪਾਉਂਦੇ ਹਨ ਅਤੇ ਆਪਣਾ ਗਿਆਨ ਵੰਡਦੇ ਹਨ ਕਈ ਤਰ੍ਹਾਂ ਦਾ ਹੋਰ ਕੰਮ ਵੀ ਸ਼ੁਰੂ ਹੈ ਜਿੱਦਾਂ ਲੋਕ ਸਟੈਂਡਅਪ ਕਮੇਡੀਅਨ ਵਾਲਾ ਵੀ ਕੰਮ ਸ਼ੁਰੂ ਹੋ ਗਿਆ ਹੈ ਜਿੱਦਾਂ ਕਪਿਲ ਸ਼ਰਮਾ ਸ਼ੋ ਹੈ ਉੱਥੋਂ ਲੋਕ ਪ੍ਰੇਰਿਤ ਹੋ ਕੇ ਕਮੇਡੀ ਕਰਦੇ ਹਨ ਸਟੇਜ 'ਤੇ ਖੜ੍ਹੇ ਹੋ ਕੇ ਅਤੇ ਨਾਲੇ ਲੋਕਾਂ ਨੂੰ ਹਸਾਉਂਦੇ ਹਨ ਅਤੇ ਉਹ 'ਚ ਉਹਨਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ ਨਵੀਂ ਪੀੜੀ ਨਵੇਂ ਨਵੇਂ ਤਰ੍ਹਾਂ ਦੇ ਕੰਮ ਕਰ ਰਹੀ ਹੈ ਜਿੱਦਾਂ ਕਿ ਉਹ ਅੱਜ ਕੱਲ੍ਹ ਆਪਣੇ ਘਰ ਗੱਡੀ ਪਈ ਟੈਕਸੀ ਹੋ ਪਾ ਕੇ ਉੱਥੋਂ ਹੀ ਕਮਾਈ ਕਰਦੇ ਹਨ ਜਿੱਦਾਂ ਕਿ ਉਹ ਲੋਕਾਂ ਨੂੰ ਇੱਧਰ ਉੱਧਰ ਪਹੁੰਚਾਉਣਾ ਅਤੇ ਨਾਲੇ ਊਬਰ ਔਟ ਔਟੋ ਬਣਾ ਕੇ ਵੀ ਕਮਾ ਰਹੇ ਨੇ ਧੰਨਵਾਦ ਜੀ